ਕਾਰੋਬਾਰ ਸ਼ੁਰੂ ਕਰਨ ਲਈ ਪੂੰਜੀ ਦੀ ਸਭ ਤੋਂ ਪਹਿਲਾਂ ਲੋੜ ਪੈਂਦੀ ਹੈ ਕਿਉਂਕਿ ਜਦੋਂ ਵੀ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਜੋ ਕਿ ਹੈ ਪੂੰਜੀ ਦੀ ਹੀ ਲੋੜ ਪੈਂਦੀ ਹੈ ਕਿਉਂਕਿ ਜਦੋਂ ਵੀ ਅਸੀਂ ਕਿਸੇ ਤੋਂ ਬੋਲਦੇ ਵੀ ਆਪਾਂ ਆਹ ਚੀਜ਼ ਦੁਕਾਨ ਸ਼ੁਰੂ ਕਰਨੀ ਹੈ ਤਾਂ ਉਹ ਬੋਲਦੇ ਵੀ ਪਹਿਲਾਂ ਸਾਨੂੰ ਪੈਸੇ ਦੇਵੋ ਤਾਂ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਐਵੇਂ ਹੀ ਕਿਸੇ ਪਰ ਟਰੱਸਟ ਨਹੀਂ ਕੀਤਾ ਜਾ ਸਕਦਾ ਹੈ ਕੀ ਪਤਾ ਉਹ ਬਾਅਦ ਵਿੱਚ ਦੁਕਾਨ ਖੋਲ੍ਹੇ ਹੀ ਨਾ ਐਵੇਂ ਕਿਤੇ ਚਲ ਜਾ ਭੱਜ ਜਾਵੇ ਤਾਂ ਇਸ ਲਈ ਪੂੰਜੀ ਦੀ ਸਾਨੂੰ ਖੁਦ ਤੋਂ ਹੀ ਲੋੜ ਪਹਿਲੇ ਪੂੰਜੀ ਇਕੱਠੀ ਕਰਨੀ ਪੈਂਦੀ ਫਿਰ ਉਸ ਬਾਰੇ ਜਾਣਕਾਰੀ ਲੈਣੀ ਪੈਂਦੀ ਜਿਵੇਂ ਕਿ ਅਸੀਂ ਗੱਲ ਕਰ ਸਕਦੇ ਹਾਂ ਇੱਕ ਦੁਕਾਨ ਦੀ ਮਨਿਆਰੀ ਦੀ ਦੁਕਾਨ ਦੀ ਮਨਿਆਰੀ ਦੀ ਦੁਕਾਨ ਖੋਲ੍ਹਣ ਲਈ ਉਸ ਦੇ ਵਿੱਚ ਜੋ ਵੀ ਸਮਾਨ ਆਉਂਦਾ ਹੈ ਕਿਉਂਕਿ ਟਰੈਂਡ ਵੀ ਚੇਂਜ ਹੋ ਜਾਂਦਾ ਹੈ ਕਦੇ ਅਸੈਸਰੀ ਕਿਉਂਕਿ ਵਿਆਹ ਆ ਜਾਂਦੇ ਕਦੇ ਵਿਆਹ ਨਹੀਂ ਹੁੰਦੇ ਤਾਂ ਉਸ ਹਿਸਾਬ ਨਾਲ ਸਾਨੂੰ ਦੇਖਣਾ ਪੈਂਦਾ ਵੀ ਸਮਾਨ ਸਾਨੂੰ ਕਿੰਨਾ ਮੰਗਵਾਉਣਾ ਹੈ ਕਿਆ ਪਤਾ ਹੁੰਦਾ ਵੀ ਵਿਆਹ ਕੋਈ ਨਾ ਹੁੰਦਾ ਹੋਵੇ ਸਾਨੂੰ ਸਿੰਪਲ ਲੋੜ ਜਿਹੜੀ ਹੁੰਦੀ ਹੈ ਉਹ ਹੋਵੇ ਕਈ ਵੇਲੇ ਆਪਣੀ ਦੁਕਾਨ 'ਚ ਉਹ ਨਹੀਂ ਹੁੰਦਾ ਫਿਰ ਆਪਣੀ ਦੁਕਾਨ ਦਾ ਜੋ ਵੀ ਮਾਲ ਉਹ ਖਰਾਬ ਹੋ ਜਾਂਦਾ ਹੈ ਅਤੇ ਜੇ ਦੇਖਿਆ ਜਾਵੇ ਤਾਂ ਆਪਣੇ ਕਰਿਆਨੇ ਦੀ ਦੁਕਾਨ ਦਾ ਵੀ ਸੇਮ ਇਹੀ ਹੈ ਉਹਨੂੰ ਵੀ ਖੋਲ੍ਹਣ ਲਈ ਦੋ ਚਾਰ ਲੱਖ ਲੱਗ ਜਾਂਦਾ ਹੈ ਉਹਦੇ ਵਿੱਚ ਜਿਹੜਾ ਸਮਾਨ ਰੱਖਣਾ ਹੈ ਉਹ ਵੀ ਦੇਖਣਾ ਪੈਂਦਾ ਵੀ ਕਿੰਨਾ ਕੁ ਰੱਖਣਾ ਕਿਉਂਕਿ ਜੋ ਦਾਲਾਂ ਵਗੈਰਾ ਉਹ ਜ਼ਿਆਦਾ ਟਾਈਮ ਨਹੀਂ ਰਹਿੰਦੀਆਂ ਉਹ ਖਰਾਬ ਹੋ ਜਾਂਦੀਆਂ ਹੈ ਅਤੇ ਹੋਰ ਵੀ ਬਹੁਤ ਸਮਾਨ ਹੁੰਦੇ ਜਿੰਨਾ ਦੀ ਸਿਰਫ ਡੇਟ ਐਕਸਪਾਇਅਰ ਹੋ ਜਾਂਦੀ ਹੈ ਤਾਂ ਦੇਖਣਾ ਪੈਂਦਾ ਵੀ ਕਿੰਨਾ ਸਾਡੀ ਸਮਾਨ ਦੀ ਸੇਲ ਹੋਣੀ ਹੈ ਵੀ ਅਸੀਂ ਕਿੰਨੇ ਤੱਕ ਦੀ ਸੇਲ ਕਰ ਸਕਦੇ ਹਾਂ ਵੀ ਅਸੀਂ ਕਿੰਨਾ ਖਰੀਦਣਾ ਹੈ